ਜੇਕਰ ਸੱਭਿਆਚਾਰ ਦੀ ਗੱਲ ਕੀਤੀ ਜਾਵੇ ਤਾਂ ਹਰ ਇੱਕ ਖਿੱਤਾ ਹਰ ਇੱਕ ਦੇਸ਼ ਦਾ ਵੱਖਰਾ ਵੱਖਰਾ ਸੱਭਿਆਚਾਰ ਹੁੰਦਾ ਹੈ ਸੱਭਿਆਚਾਰ ਦੇ ਵਿੱਚ ਉੱਥੋਂ ਦਾ ਰਹਿਣ ਸਹਿਣ ਉੱਥੋਂ ਦੀ ਭਾਸ਼ਾ ਖਾਣ ਪੀਣ ਪਹਿਰਾਵਾ ਰਸਮ ਰਿਵਾਜ ਇਹ ਸਭ ਕੁਝ ਸੱਭਿਆਚਾਰ ਦੇ ਵਿੱਚ ਸ਼ਾਮਿਲ ਹੁੰਦਾ ਹੈ ਸੱਭਿਆਚਾਰ 'ਤੇ ਪ੍ਰਭਾਵ ਪਾਉਣ ਦੇ ਪਾਉਣ ਵਾਲੇ ਵੱਖ ਵੱਖ ਪਹਿਲੂ ਹੁੰਦੇ ਹਨ ਜਿਵੇਂ ਕਿ ਭੂਗੋਲਿਕ ਸਥਿਤੀਆਂ ਆਰਥਿਕ ਸਥਿਤੀਆਂ ਲੋਕਾਂ 'ਤੇ ਰਾਜ ਕਰਨ ਵਾਲੇ ਜਗੀਰਦਾਰ ਜੇਕਰ ਆਪਾਂ ਗੱਲ ਕਰੀਏ ਕਿ ਸਾਡੇ ਰਾਜ ਦੇ ਸੱਭਿਆਚਾਰ ਨੂੰ ਕਿਸ ਨੇ ਰੂਪ ਦਿੱਤਾ ਜਾਂ ਅਮੀਰ ਬਣਾਉਣ ਲਈ ਕਿਹਨਾਂ ਕਿਹਨਾਂ ਦਾ ਯੋਗਦਾਨ ਹੈ ਤਾਂ ਇਸ ਵਿੱਚ ਸਾਡੇ ਪੁਰਖੇ ਜਿਹਨਾਂ ਦਾ ਇਸ ਵਿੱਚ ਯੋਗਦਾਨ ਹੈ ਸਾਡੇ ਪੁਰਖੇ ਪੀੜ੍ਹੀ ਦਰ ਪੀੜ੍ਹੀ ਸੱਭਿਆਚਾਰਕ ਕਦਰਾਂ ਕੀਮਤਾਂ ਨੂੰ ਅੱਗੇ ਵਧਾਉਂਦੇ ਗਏ ਜੋ ਹੁਣ ਸਾਡੇ ਕੋਲ ਪਹੁੰਚ ਚੁੱਕੀਆਂ ਹਨ ਇਹ ਕਦਰਾਂ ਕੀਮਤਾਂ ਨੂੰ ਸਮੇਂ ਦੇ ਨਾਲ ਨਾਲ ਬਦਲਣਾ ਪੈਂਦਾ ਹੈ ਕਿਉਂਕਿ ਜਿਵੇਂ ਜਿਵੇਂ ਸਮਾਜ ਵਿੱਚ ਤਬਦੀਲੀ ਆਉਂਦੀ ਹੈ ਸੱਭਿਆਚਾਰਕ ਕਦਰਾਂ ਕੀਮਤਾਂ ਵੀ ਬਦਲਦੀਆਂ ਰਹਿੰਦੀਆਂ ਹਨ ਅਸੀਂ ਇਸ ਵਿੱਚ ਕਿਸੇ ਇੱਕ ਮਨੁੱਖ ਦਾ ਯੋਗਦਾਨ ਕਹੀਏ ਤਾਂ ਉਸ ਵਿੱਚ ਉਹ ਗੱਲ ਇੱਕ ਵਿਡੰਬਣਾ ਹੋਵੇਗੀ ਕਿਉਂਕਿ ਸੱਭਿਆਚਾਰ ਨੂੰ ਬਣਾਉਣ ਲਈ ਕੋਈ ਇੱਕ ਮਨੁੱਖ ਆਪਣਾ ਖ਼ਾਸ ਯੋਗਦਾਨ ਨਹੀਂ ਪਾ ਸਕਦਾ ਇਹ ਲੋਕ ਸਮੂਹ ਦਾ ਹਿੱਸਾ ਹੁੰਦਾ ਹੈ ਲੋਕ ਸਮੂਹ ਰਾਹੀਂ ਹੀ ਸੱਭਿਆਚਾਰ ਬਣਦਾ ਅਤੇ ਜੇਕਰ ਉਸ ਨੂੰ ਪ੍ਰਵਾਨਗੀ ਮਿਲਦੀ ਹੈ ਤਾਂ ਉਹ ਪੀੜ੍ਹੀ ਦਰ ਪੀੜ੍ਹੀ ਅੱਗੇ ਤੁਰਦਾ ਜਾਂਦਾ ਹੈ ਜੋ ਸਮੇਂ ਦੇ ਨਾਲ ਕੁਰੀਤੀਆਂ ਹੁੰਦੀਆਂ ਹਨ ਉਹ ਪਿੱਛੇ ਰਹਿ ਜਾਂਦੀਆਂ ਹਨ ਅਤੇ ਨਵੇਂ ਢੰਗ ਤਰੀਕੇ ਸਭਿਆਚਾਰ ਦੇ ਵਿੱਚ ਜੁੜਦੇ ਰਹਿੰਦੇ ਹਨ ਇਸ ਲਈ ਜੇਕਰ ਅਸੀਂ ਸਿੱਟਾ ਕੱਢੀਏ ਤਾਂ ਸੱਭਿਆਚਾਰ ਨੂੰ ਅਮੀਰ ਬਣਾਉਣ ਵਿੱਚ ਸਾਡੇ ਪੁਰਖੇ ਸਾਡੇ ਲੋਕ ਸਮੂਹਾਂ ਦਾ ਮਹੱਤਵਪੂਰਨ ਯੋਗਦਾਨ ਹੈ ਜੇਕਰ ਕ ਆਪਾਂ ਕਿਸੇ ਇੱਕ ਇਨਸਾਨ ਬਾਰੇ ਗੱਲ ਕਰੀਏ ਤਾਂ ਇਹ ਕਹਿਣਾ ਠੀਕ ਨਹੀਂ ਹੋਵੇਗਾ ਕਿ ਇਹ ਇੱਕ ਇਨਸਾਨ ਦੀ ਦੇਣ ਹੈ